ਮੇਰਾ ਨਾਮ ਨਿਸ਼ਾ ਹੈ ਮੈਂ ਕੇ ਸੀ ਕਾਲਜ ਵਿੱਚ ਐਜ਼ ਆ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਡੇਲੀ ਹੀ ਤੁਹਾਡੀ ਜਮੈਟੋ ਸਾਈਟ ਤੋਂ ਆਪਣਾ ਦੁਪਹਿਰ ਦਾ ਲੰਚ ਮੰਗਵਾਉਂਦੀ ਹਾਂ ਅਤੇ ਤੁਸੀਂ ਮੈਨੂੰ ਰੋਜ਼ ਲੰਚ ਦੇ ਕੇ ਜਾਂਦੇ ਆ ਪਰ ਅਗਲੇ ਪੰਦਰਾਂ ਦਿਨ ਤੱਕ ਮੈਂ ਸ਼ਹਿਰ ਤੋਂ ਬਾਹਰ ਜਾ ਰਹੀ ਹਾਂ ਆਪਣੀ ਫੈਮਲੀ ਦੇ ਨਾਲ ਘੁੰਮਣ ਦੇ ਲਈ ਅਤੇ ਅਗਲੇ ਪੰਦਰਾਂ ਦਿਨ ਤੱਕ ਮੈਂ ਕੋਲਜ ਤੋਂ ਛੁੱਟੀਆਂ ਲਈਆਂ ਹੋਈਆਂ ਹਨ ਅਤੇ ਜਿੱਦਾਂ ਤੁਸੀਂ ਮੈਨੂੰ ਡੇਲੀ ਦੁਪਹਿਰ ਦਾ ਲੰਚ ਦੇ ਕੇ ਜਾਂਦੇ ਹੋ ਇੱਥੇ ਕੋਲਜ ਦੇ ਵਿੱਚ ਪਰ ਅਗਲੇ ਪੰਦਰਾਂ ਦਿਨ ਦੇ ਲਈ ਮੈਂ ਕੋਈ ਵੀ ਔਡਰ ਨਹੀਂ ਕਰਨਾ ਚਾਹੁੰਦੀ ਹਾਂ ਜਿਸ ਕਰਕੇ ਮੈਂ ਆਪਣੇ ਫੋਨ ਤੋਂ ਵੀ ਇਹ ਸਾਰੀਆਂ ਜਿੰਨੀਆਂ ਵੀ ਮੈਂ ਤੁਹਾਨੂੰ ਔਨਲਾਈਨ ਔਡਰ ਕਰਦੀ ਸੀਗੀ ਜੋ ਕਿ ਡੇਲੀ ਤੁਹਾਡੇ ਕੋਲ ਪਹੁੰਚ ਜਾਂਦਾ ਸੀਗਾ ਕਿਉਂਕਿ ਮੈਂ ਆਟੋਮੋਬਾਈਲ ਕੀਤਾ ਹੋਇਆ ਸੀਗਾ ਅਤੇ ਡੇਲੀ ਤੁਹਾਡੇ ਕੋਲ ਮਤਲਬ ਕਿ ਰਿਕੁਐਸਟ ਪਹੁੰਚ ਜਾਂਦੀ ਸੀਗੀ ਕਿ ਭੋਜਨ ਲੈ ਕੇ ਆ ਜਾਉ ਕੇ ਸੀ ਕੋਲਜ ਦੇ ਵਿੱਚ ਪਰ ਕੁਝ ਕਾਰਨਾਂ ਕਰਕੇ ਹੁਣ ਮੈਂ ਕੋਲਜ ਤੋਂ ਬਾਹਰ ਜਾ ਰਹੀ ਹਾਂ ਜਿਸ ਕਰਕੇ ਕਿ ਮੈਂ ਅਗਲੇ ਪੰਦਰਾਂ ਦਿਨ ਤੱਕ ਕੋਈ ਵੀ ਭੋਜਨ ਔਡਰ ਨਹੀਂ ਕਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਮੋਬਾਇਲ ਤੋਂ ਵੀ ਸਾਰੀਆਂ ਸੁਵਿਧਾਵਾਂ ਨੂੰ ਡਿਸਕਨੈਕਟ ਕਰ ਦਿੱਤਾ ਹੈਗਾ ਆ ਤੁਸੀਂ ਵੀ ਆਪਣੇ ਸਾਈਡ ਤੋਂ ਉਹਨਾਂ ਨੂੰ ਡਿਸਕਨੈਕਟ ਕਰ ਦਿਉ ਤਾਂ ਕਿ ਜੇ ਤੁਸੀਂ ਮਤਲਬ ਕਿ ਭੋਜਨ ਲੈ ਕੇ ਆਉ ਤਾਂ ਮੈਂ ਇੱਥੇ ਤੁਹਾਨੂੰ ਨਾ ਮਿਲਾਂ ਤਾਂ ਤੁਹਾਡਾ ਵੀ ਟਾਈਮ ਖਰਾਬ ਹੋਵੇਗਾ ਅਤੇ ਜੇ ਮਤਲਬ ਕਿ ਮੇਰੇ ਵੱਲੋਂ ਵੀ ਫਿਰ ਤੁਹਾਨੂੰ